ਜਿੱਦਾਂ ਕਿ ਮੈਂ ਸਵਾਸਥ ਬੀਮਾ ਵਿੱਚ ਦਾ ਇੰਮਪਲੋਏ ਹਾਂ ਤਾਂ ਸਾਡੀ ਕੰਪਨੀ ਹੈਲਥ ਨੂੰ ਬਹੁਤ ਪਰੋਮੋਟ ਕਰਦੀ ਹੈ ਹੈਲਥ ਤੋਂ ਭਾਵ ਹੈ ਆਪਣੇ ਆਪਣੀ ਫਿੱਟਨੈਸ ਬਾਰੇ ਸਾਡੀ ਕੰਪਨੀ ਆਪਣੇ ਗ੍ਰਾਹਕਾਂ 'ਤੇ ਜ਼ੋਰ ਪਾਉਂਦੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਐਜ਼ ਆ ਇੰਮਪਲੋਏ ਮੈਂ ਵੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੀ ਸਿਹਤ ਦਾ ਖਿਆਲ ਰੱਖ ਸਕਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਡੇਲੀ ਦੇ ਟੈਨ ਥਾਊਸੈਂਡ ਸਟੈਪਸ ਚੱਲ ਸਕਾਂ ਜਿਸ ਨਾਲ ਮੇਰੀ ਸਿਹਤ ਤੰਦਰੁਸਤ ਰਹੇ ਇੱਕ ਸਟੱਡੀ ਦੇ ਅਨੁਸਾਰ ਜੇ ਕੋਈ ਇਨਸਾਨ ਪਰ ਡੇ ਟੈਨ ਥਾਊਸੈਂਡ ਸਟੈਪਸ ਚਲਦਾ ਹੈ ਤਾਂ ਉਹ ਵੈਸੇ ਹੀ ਅਰੋਗਯ ਰਹੇਗਾ ਤਾਂ ਅਸੀਂ ਵੀ ਆਪਣੇ ਗ੍ਰਾਹਕਾਂ ਨੂੰ ਇਸ ਚੀਜ਼ ਲਈ ਪਰੋਮੋਟ ਕਰਦੇ ਹਾਂ ਕਿ ਤੁਸੀਂ ਵੀ ਡੇਲੀ ਟੈਨ ਥਾਊਸੈਂਡ ਸਟੈਪਸ ਚੱਲਣ ਦੀ ਕੋਸ਼ਿਸ਼ ਕਰੋ ਅਤੇ ਫਿੱਟ ਰਹੋ ਅਤੇ ਜੇ ਮੈਂ ਖਾਣ ਪੀਣ ਦੀ ਗੱਲ ਕਰਾਂ ਤਾਂ ਮੈਂ ਇੱਕ ਵੈਜੀਟੇਰੀਅਨ ਹਾਂ ਅਤੇ ਮੈਂ ਨੌਨ ਐਲਕੋਹਲਿਕ ਹਾਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਫਾਈਬਰ ਅਤੇ ਪ੍ਰੋਟੀਨ ਡਾਈਟ ਨੂੰ ਆਪਣੇ ਖਾਣੇ ਵਿੱਚ ਜ਼ਿਆਦਾਤਰ ਰੱਖਾਂ ਜਿਸ ਨਾਲ ਮੈਂ ਫਿੱਟ ਰਹਿ ਸਕਾਂ ਮੈਂ ਰਨਿੰਗ ਅਤੇ ਜੀਮਿੰਗ ਕਰਨ ਦਾ ਵੀ ਸ਼ੌਕੀਨ ਹਾਂ ਜਿਸ ਨਾਲ ਮੈਂ ਫਿੱਟ ਰਹਿੰਦਾ ਹਾਂ ਮੈਂ ਕਾਰਬੋਹਾਈਡਰੇਟਸ ਵਾਲੀ ਡਾਈਟ ਬਹੁਤ ਘੱਟ ਖਾਂਦਾ ਹਾਂ ਜਿਸ ਨਾਲ ਮੇਰੀ ਬੌਡੀ 'ਚ ਫੈਟ ਪ੍ਰਸੈਂਟੇਜ ਘੱਟਦੀ ਹੈ ਅਤੇ ਪ੍ਰੋਟੀਨ ਡਾਈਟ ਜ਼ਿਆਦਾ ਖਾਣ ਨਾਲ ਤੁਹਾਡੀ ਬੌਡੀ ਦੀ ਮਸਕੁਲੈਰੀਟੀ ਵੱਧਦੀ ਹੈ